ਮੇਰਾ ਮਨਪਸੰਦ ਮੌਸਮ ਜੋ ਹੈ ਉਹ ਗਰਮੀ ਹੈ ਕਿਉਂਕਿ ਗਰਮੀਆਂ ਦੇ ਵਿੱਚ ਅਸੀਂ ਬਹੁਤ ਹੀ ਰਿਲੈਕਸ ਫੀਲ ਕਰਦੇ ਹਾਂ ਸਰਦੀਆਂ ਦੇ ਵਾਂਗ ਸਾਨੂੰ ਬਹੁਤ ਜ਼ਿਆਦਾ ਕੱਪੜੇ ਜੋ ਹੈ ਨਹੀਂ ਪਹਿਨਣੇ ਪੈਂਦੇ ਅਤੇ ਅਸੀਂ ਹ ਹੈਵੀ ਹੈਵੀ ਮਤਲਬ ਕਲੌਥਸ ਨਾਲ ਨਹੀਂ ਹੁੰਦੇ ਇਸ ਲਈ ਥੋੜ੍ਹਾ ਰਿਲੈਕਸ ਫੀਲ ਹੁੰਦਾ ਹੈ ਅਤੇ ਗਰਮੀਆਂ ਦੇ ਵਿੱਚ ਜਦੋਂ ਵੀ ਸਾਨੂੰ ਗਰਮੀਆਂ ਦੀਆਂ ਛੁੱਟੀਆਂ ਪੈਂਦੀਆਂ ਸਕੂਲ ਤੋਂ ਉਸ ਟਾਈਮ ਅਸੀਂ ਬਾਹਰ ਕਿਤੇ ਵੀ ਫਰੈਂਡ ਨਾਲ ਫੈਮਿਲੀ ਨਾਲ ਘੁੰਮਣ ਜਾਈਦਾ ਅਤੇ ਉੱਥੇ ਬਹੁਤ ਇਨਜੋਏ ਕਰੀਦਾ ਫੌਰ ਇਗਜੈਂਪਲ ਕਬੀ ਗੋਆ ਕਦੀ ਸ਼ਿਮਲਾ ਚੱਲ ਗਏ ਗੋਆ ਦੇ ਵਿੱਚ ਜਾ ਕੇ ਅਸੀਂ ਬੀਚ ਦੇ ਨਜ਼ਾਰੇ ਲਈ ਦੇ ਆ ਪਾਣੀ ਦੇ ਪਾਸ ਬੈਠ ਕੇ ਬਹੁਤ ਮਜ਼ਾ ਆਉਂਦਾ ਫਰੈਂਡਸ ਨਾਲ ਖੇਡ ਕੇ ਅਤੇ ਸ਼ਿਮਲਾ ਦੇ ਵਿੱਚ ਜਾ ਕੇ ਜਿਵੇਂ ਸਨੋਅ ਫੌਲਸ ਵਗੈਰਾ ਹੁੰਦੀਆਂ ਵਾ ਬਰਫ਼ ਨਾਲ ਖੇਡਣ ਦੇ ਵਿੱਚ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ ਹੈ ਆਪਾਂ ਹਰ ਹਰ ਵਾਰ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਕਦੀ ਫੈਮਿਲੀ ਨਾਲ ਅਤੇ ਕਦੀ ਫਰੈਂਡਸ ਨਾਲ ਉੱਥੇ ਜਾਈਦਾ ਸਾਨੂੰ ਬਹੁਤ ਮਜ਼ਾ ਆਉਂਦਾ ਹੈ ਅਤੇ ਗਰਮੀਆਂ ਦੇ ਵਿੱਚ ਇੱਕ ਸਭ ਤੋਂ ਵਧੀਆ ਹੈ ਕਿ ਅਸੀਂ ਆਈਸ ਕਰੀਮ ਕੁਲਫ਼ੀ ਜੋ ਖਾਂਦੇ ਹਾਂ ਉਹ ਬਹੁਤ ਹੀ ਵਧੀਆ ਲੱਗਦੀ ਆ ਬਹੁਤ ਮਜ਼ਾ ਆਉਂਦਾ ਕੁਲਫ਼ੀ ਵਗੈਰਾ ਖਾ ਕੇ ਅਤੇ ਗਰਮੀਆਂ ਦੇ ਵਿੱਚ ਕਾਫ਼ੀ ਇਨਜੋਏ ਕਰੀਦਾ ਵਾ ਬਹੁਤ ਮਸਤੀ 'ਚ ਕਰੀਦੀ ਆ ਥੈਂਕ ਯੂ